ਅੱਜ ਕੱਲ੍ਹ ਤਾਂ ਕਿਤਾਬਾਂ ਮੈਂ ਐਮਾਜ਼ੋਨ ਤੋਂ ਜਾਂ ਫਲਿੱਪਕਾਰਟ ਤੋਂ ਖਰੀਦਦਾਂ ਸਾਡੇ ਸ਼ਹਿਰ ਦੇ ਵਿੱਚ ਵੀ ਇੱਕ ਸਟੋਰ ਹੈ ਜਿੱਥੇ ਸੈਕਿੰਡ ਹੈਂਡ ਕਿਤਾਬਾਂ ਮਿਲਦੀਆਂ ਹਨ ਪਰ ਮੈਨੂੰ ਇੱਕ ਇੰਟਰਸਟਿੰਗ ਵਾਕਿਆ ਯਾਦ ਆਉਂਦਾ ਕਿ ਮੈਂ ਅਸੀਂ ਇੱਕ ਟੂਰ 'ਤੇ ਗਏ ਸੀ ਸਾਡਾ ਡਿਗਰੀ ਐਂਡਿੰਗ ਟੂਰ ਸੀ ਅਤੇ ਮੇਰੇ ਕੋਲ ਕਰੀਬ ਕਰੀਬ ਦੋ ਸੌ ਰੁਪਇਆ ਬਚਿਆ ਸੀ ਮੇਰੇ ਸਾਰੇ ਦੋਸਤ ਜਿਹੜੇ ਉਸ ਦਿਨ ਐਸਲ ਵਰਲਡ ਗਏ ਸੀ ਅਤੇ ਮੇਰੇ ਕੋਲ ਪੈਸੇ ਘੱਟ ਹੋਣ ਕਰਕੇ ਮੈਂ ਸਿਰਫ਼ ਦੋ ਸੌ ਰੁਪਈਆ ਸੀ ਅਤੇ ਮੈਂ ਐਸਲ ਵਰਲਡ ਨਹੀਂ ਜਾ ਸਕਿਆ ਅਤੇ ਮੈਂ ਉਹ ਸਮੁੰਦਰ ਦੇ ਕੰਢੇ ਬੋਮਬੇ ਗਏ ਸੀ ਅਸੀਂ ਜਦੋਂ ਅਤੇ ਉੱਥੇ ਪੈਦਲ ਨਿਕਲ ਗਿਆ ਉੱਥੋਂ ਅਤੇ ਘੁੰਮਦਾ ਘੁੰਮਦਾ ਘੁੰਮਦਾ ਰਸਤੇ ਦੇ ਵਿੱਚ ਸੜਕ ਦੇ ਉੱਤੇ ਨਾ ਬਹੁਤ ਸਾਰੀਆਂ ਕਿਤਾਬਾਂ ਵੇਚਣ ਵਾਲੇ ਬੈਠੇ ਸੀ ਅਤੇ ਮੇਰਾ ਇੱਕ ਫੇਵਰੇਟ ਔਥਰ ਹੁੰਦਾ ਸੀ ਰੋਬਿਨ ਕੁੱਕ ਮੈਂ ਉੱਥੇ ਕਿਤਾਬਾਂ ਵੇਖੀਆਂ ਰੋਬਿਨ ਕੁੱਕ ਦੀਆਂ ਕਿਤਾਬਾਂ ਪਈਆਂ ਸੀ ਉਹ ਇੰਡੀਅਨ ਐਡੀਸ਼ਨ ਸੀ ਸਸਤਾ ਵੀ ਸੀ ਅਤੇ ਮੈਂ ਉਸਨੂੰ ਪੁੱਛਿਆ ਮੈਂ ਇਹ ਕਿੰਨੇ ਦੀ ਕਿਤਾਬ ਆ ਤਾਂ ਉਹ ਬੰਦੇ ਨੇ ਕਿਹਾ ਕਿ ਇੱਕ ਕਿਤਾਬ ਅੱਸੀ ਰੁਪਏ ਦੀ ਹੈ ਮੈਂਨੂੰ ਤਿੰਨ ਕਿਤਾਬਾਂ ਲੱਭੀਆਂ ਉੱਥੋਂ ਅਤੇ ਦੋ ਸੌ ਚਾਲੀ ਰੁਪਈਏ ਬਣਦੇ ਸੀ ਮੇਰੇ ਕੋਲ ਦੋ ਸੌ ਰੁਪਈਆ ਸੀ ਟੋਟਲ ਅਤੇ ਪਰ ਮੈਂ ਕਿਉਂਕਿ ਪੈਸੇ ਥੋੜ੍ਹੇ ਜਿਹੇ ਬਚਾਉਣਾ ਵੀ ਚਾਹੁੰਦਾ ਮੈਂ ਉਸਨੂੰ ਬੜਾ ਕਿਹਾ ਫਿਰ ਉਹ ਮੰਨ ਗਿਆ ਮੈਂ ਉਹਨੂੰ ਕਿਹਾ ਕਿ ਮੈ ਮੈਨੂੰ ਬੁੱਕ ਚਾਹੀਦੀ ਹੈ ਉਹਨੇ ਮੈਨੂੰ ਤਿੰਨ ਕਿਤਾਬਾਂ ਇੱਕ ਸੌ ਚਾਲੀ ਰੁਪਏ ਦੇ ਵਿੱਚ ਦੇ ਦਿੱਤੀਆਂ ਮੇਰੇ ਕੋਲ ਸੱਠ ਰੁਪਏ ਬਚੇ ਦਸ ਰੁਪਏ ਦਾ ਮੈਂ ਉੱਥੋਂ ਛੱਲੀ ਲੈ ਕੇ ਖਾਦੀ ਅਤੇ ਸ਼ਾਮ ਤੱਕ ਬਾਕੀ ਸਾਰੇ ਮੇਰੇ ਦੋਸਤ ਵੀ ਵਾਪਿਸ ਆ ਗਏ ਉਹ ਤਾਂ ਇੱਕ ਐਸਲ ਵਰਲਡ ਦੀ ਯਾਦ ਲੈ ਕੇ ਆਏ ਕਿ ਅਸੀਂ ਉੱਥੇ ਝੂਟੇ ਲਏ ਪਰ ਮੇਰੇ ਕੋਲ ਤਿੰਨ ਕਿਤਾਬਾਂ ਸੀ ਜਿਹੜੀਆਂ ਕਿ ਮੇਰੇ ਲਈ ਅਗਲੀ ਗੱਲ ਉਹ ਕਿ ਤਿੰਨ ਹਫ਼ਤਿਆਂ ਵਾਸਤੇ ਮੇਰੇ ਲਈ ਬੜਾ ਵਧੀਆ ਸਾਥ ਸੀ ਮੈਂ ਕਿਤਾਬਾਂ ਕਿਤੋਂ ਵੀ ਜਿੱਥੋਂ ਵੀ ਮਿਲਦੀਆਂ ਨੇ ਮੈਂ ਖਰੀਦ ਲੈਂਦਾ ਚਾਹੇ ਉਹ ਲੋਕਲ ਮਾਰਕੀਟ ਹੋਵੇ ਜਾਂ ਕੋਈ ਰੇੜ੍ਹੀ ਵਾਲਾ ਬੈਠਾ ਹੋਵੇ ਜਾਂ ਥੱਲੇ ਚਾਦਰ ਵਿਛਾ ਕੇ ਕੋਈ ਵੇਚਦਾ ਹੋਵੇ ਮੈਂ ਕਿਤਾਬਾਂ ਜੇ ਮੈਨੂੰ ਇੰਟਰਸਟਿੰਗ ਲੱਗਦੀਆਂ ਤਾਂ ਮੈਂ ਖਰੀਦ ਲੈਂਦਾ